ਪੰਜਾਬ ਵਿੱਚ ਬਹੁਤ ਮਹੱਤਵਪੂਰਨ ਸੱਭਿਆਚਾਰਕ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਮਨਾਏ ਜਾਂਦੇ ਹਨ ਜਿਨਾਂ ਵਿੱਚ ਸਭ ਤੋਂ ਵੱਧ ਪੰਜਾਬੀ ਭੰਗੜਾ ਮਲਵਈ ਗਿੱਧਾ ਅਤੇ ਔਰਤਾਂ ਦਾ ਗਿੱਧਾ ਮਸ਼ਹੂਰ ਹਨ ਜੋ ਬਹੁਤ ਹੀ ਚਾਓ ਨਾਲ ਮਨਾਏ ਜਾਂਦੇ ਹਨ ਬਹੁਤ ਹੀ ਵਧੀਆ ਤਰੀਕੇ ਨਾਲ ਭੰਗੜਾ ਪਾਇਆ ਜਾਂਦਾ ਹੈ ਅਤੇ ਵਿਆਹਾਂ ਵਿੱਚ ਛਟੀਆਂ ਦੇਖਣ ਨੂੰ ਖੇਡਣ ਨੂੰ ਮਿਲਦੀਆਂ ਹਨ ਉਹ ਵੀ ਬਹੁਤ ਹੀ ਮਸ਼ਹੂਰ ਹੈ ਜਦੋਂ ਕਦੇ ਕਿਸੇ ਦੀ ਮਰਕਤ ਹੋ ਜਾਂਦੀ ਹੈ ਤਾਂ ਉੱਥੇ ਕਿਸੇ ਜਗ੍ਹਾ ਸੋਲ੍ਹਵਾਂ ਮਨਾਇਆ ਜਾਂਦਾ ਹੈ ਕਿਸੀ ਜਗ੍ਹਾ ਬਾਰ੍ਹਵਾਂ ਮਨਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਗੁਰਦੁਆਰੇ ਹਨ ਪੰਜਾਬ ਵਿੱਚ ਜਿਹਨਾਂ ਜਿਹਨਾਂ ਵਿੱਚ ਬਹੁਤ ਹੀ ਧੂਮਧਾਮ ਨਾਲ ਤਿਉਹਾਰ ਮਨਾਏ ਜਾਂਦੇ ਹਨ ਜਿਸ ਤਰ੍ਹਾਂ ਦਿਵਾਲੀ ਅੰਮ੍ਰਿਤਸਰ ਦੀ ਬਹੁਤ ਹੀ ਮਸ਼ਹੂਰ ਹੈ ਅਤੇ ਅਨੰਦਪੁਰ ਸਾਹਿਬ ਵਿੱਚ ਇਸੇ ਤਰ੍ਹਾਂ ਪ੍ਰੋਗਰਾਮ ਕੀਤੇ ਜਾਂਦੇ ਹਨ ਅਜੂਬਾ ਹੈ ਅੰਮ੍ਰਿਤਸਰ ਵਿੱਚ ਜਿਸ ਦੇ ਵਿੱਚ ਪੰਜਾਬ ਦੇ ਅਸਤਰ ਸ਼ਸਤਰ ਬਹੁਤ ਹੀ ਪੁਰਾਣੇ ਦਿਖਾਏ ਜਾਂਦੇ ਹਨ ਜੋ ਕਿ ਜਿਸ ਨਾਲ ਸਾਨੂੰ ਬਹੁਤ ਹੀ ਜ਼ਿਆਦਾ ਨੌਲੇਜ ਮਿਲਦੀ ਹੈ ਕਿ ਪੰਜਾਬ ਕਿਸ ਤਰ੍ਹਾਂ ਵਸਿਆ ਕਿਸ ਤਰ੍ਹਾਂ ਉਜੜਿਆ ਉਹ ਸਭ ਦਿਖਾਇਆ ਜਾਂਦਾ ਹੈ